ਹਾਂਜੀ ਅਸੀਂ ਪੂਰੇ ਘਰ ਦੀ ਸਾਫ਼ ਸਫਾਈ ਬਹੁਤ ਚੰਗੀ ਤਰ੍ਹਾਂ ਕਰਦੇ ਹਾਂ ਪੂਰੇ ਘਰ ਨੂੰ ਝਾੜ ਝੰਬ ਕਰਕੇ ਰੱਖਦੇ ਹਾਂ ਖਾਸ ਕਰਕੇ ਰਸੋਈ ਨੂੰ ਜੇ ਰਸੋਈ ਦੀ ਪੂਰੀ ਸਫਾਈ ਕਰਦੇ ਹਾਂ ਰਸੋਈ ਦੇ ਵਿੱਚ ਹਰ ਤਰ੍ਹਾਂ ਦੀ ਸਪਰੇਅ ਵੀ ਆਈ ਹੈ ਜਿਹਨੂੰ ਅਸੀਂ ਛਿੜਕਾ ਕਰਦੇ ਹਾਂ ਜਿਹਨਾਂ ਦੀ ਸਮੈੱਲ ਸੁੰਘ ਕੇ ਤਾਂ ਕਿ ਕੋਈ ਜਹਿਰੀਲਾ ਜੀਵ ਨਾ ਆਏ ਅਤੇ ਪੋਚੇ ਵੀ ਅਸੀਂ ਜਦੋਂ ਲਗਾਉਂਦੇ ਹਾਂ ਤਾਂ ਅਸੀਂ ਪਾਣੀ ਦੇ ਵਿੱਚ ਫਨਾਈਲ ਡਟੋਲ ਜਾਂ ਕੁਛ ਹੋਰ ਵੀ ਜਹਿਰੀਲੀ ਚੀਜ਼ ਜਿਹੜੀ ਕੋਈ ਇੱਦਾਂ ਦੀ ਸਮੈੱਲ ਵਾਲੀ ਹੁੰਦੀ ਆ ਉਹਨੂੰ ਵਿੱਚ ਪਾ ਕੇ ਉਹਦੇ ਨਾਲ ਪੋਚੇ ਲਗਾਉਂਦੇ ਹਾਂ ਤਾਂ ਕਿ ਉਹਨਾਂ ਦੀ ਸਮੈੱਲ ਸੁੰਘ ਕੇ ਜਿਹੜਾ ਕੋਈ ਜਹਿਰੀਲਾ ਜੀਵ ਆਉਂਦਾ ਹੈ ਤਾਂ ਉਹ ਬਾਹਰ ਭੱਜ ਜਾਏ ਦੌੜ ਜਾਏ ਫਿਰ ਵੀ ਇਸ ਦੇ ਬਾਵਜੂਦ ਵੀ ਜੇ ਕੋਈ ਕੋਕਰੋਚ ਚੂਹਾ ਜਾਂ ਛਿਪਕਲੀ ਸਾਡੀ ਰਸੋਈ ਦੇ ਵਿੱਚ ਆ ਜਾਂਦੀ ਹੈ ਤਾਂ ਅਸੀਂ ਉਹਨੂੰ ਡੰਡੇ ਨਾਲ ਜਾਂ ਝਾੜੂ ਦੇ ਨਾਲ ਫੜ ਕੇ ਜਾਂ ਤਾਂ ਉਹਨੂੰ ਮਾਰ ਦਿੰਦੇ ਹਾਂ ਜਾਂ ਫਿਰ ਉਹਨੂੰ ਬਾਹਰ ਸੁੱਟ ਆਉਂਦੇ ਹਾਂ ਬਾਹਰ ਸੁੱਟ ਆਉਂਦੇ ਹਾਂ ਅਤੇ ਇਸ ਦੇ ਬਾਵਜੂਦ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਰਸੋਈ ਦੇ ਵਿੱਚ ਛਿਪਕਲੀ ਚੂਹਾ ਜਾਂ ਕੁਛ ਨਾ ਆਏ ਤਾਂ ਅਸੀਂ ਚੂਹੇ ਮਾਰ ਦਵਾਈ ਬਿਸਕੁਟ ਹੋਰ ਆਦੀ ਜੋ ਵੀ ਦਵਾਈਆਂ ਆਉਂਦੀਆਂ ਚੂਹਿਆਂ ਨੂੰ ਮਾਰਨ ਵਾਸਤੇ ਜਾਂ ਘਰ ਤੋਂ ਦੂਰ ਰੱਖਣ ਵਾਸਤੇ ਤਾਂ ਅਸੀਂ ਉਹਨੂੰ ਲਿਆ ਕੇ ਘਰ ਦੇ ਵਿੱਚ ਰੱਖਦੇ ਹਾਂ ਰੱਖਦੇ ਹਾਂ ਜਾਂ ਉਹਨਾਂ ਦਾ ਛਿੜਕਾਅ ਕਰਦੇ ਹਾਂ ਜਾਂ ਚੂਹਿਆਂ ਨੂੰ ਫੜਨ ਵਾਲੀ ਕੜਿੱਕੀ ਵੀ ਲਗਾ ਦਿੰਦੇ ਹਾਂ ਤਾਂ ਕਿ ਚੂਹੇ ਇਹਦੇ ਵਿੱਚ ਨਾ ਆਉਣ ਇੱਕ ਹੋਰ ਹੁੰਦਾ ਹੈ ਛਿਪਕਲੀਆਂ ਨੂੰ ਭਜਾਉਣ ਦੇ ਲਈ ਮੋਰ ਦਾ ਪੰਖ ਜਿਹੜਾ ਘਰ ਦੇ ਵਿੱਚ ਰੱਖਿਆ ਜਾਂਦਾ ਅਸੀਂ ਉਹ ਵੀ ਲਿਆ ਕੇ ਰੱਖਦੇ ਹਾਂ ਤਾਂ ਕਿ ਉਸ ਤੋਂ ਡਰਦੇ ਛਿਪਕਲੀਆਂ ਨਾ ਆਉਣ ਬਸ ਥੈਂਕਸ